ਮੈਂ ਇੰਟਰਨੈਟ ਚਲਾਉਣਾ ਜਦੋਂ ਮੈਂ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲਿਆ ਇੰਟਰਨੈਟ ਚਲਾਉਣਾ ਮੈਂ ਉਦੋਂ ਸ਼ੁਰੂ ਕੀਤਾ ਸੀ ਕਿਉਂਕਿ ਉਸ ਟਾਈਮ ਇੰਟਰਨੈਟ ਚਲਾਉਣ ਲਈ ਚਲਾਉਣਾ ਮੇਰੇ ਲਈ ਬਹੁਤ ਜ਼ਰੂਰੀ ਹੋ ਗਿਆ ਸੀ ਉਸ ਸਮੇਂ ਇੰਟਰਨੈਟ ਦੀ ਸਪੀਡ ਬਹੁਤ ਹੀ ਘੱਟ ਸੀ ਕਿਉਂਕਿ ਉਸ ਸਮੇਂ ਸਿਰਫ ਦੋ ਜੀ ਵੀ ਸਪੀਡ ਹੀ ਦਿੱਤੀ ਜਾਂਦੀ ਸੀ ਹੁਣ ਇੰਟਰਨੈਟ ਅਤੇ ਪਹਿਲਾਂ ਦੀ ਇੰਟਰਨੈਟ ਦੇ ਵਿੱਚ ਕਾਫੀ ਅੰਤਰ ਆ ਗਿਆ ਹੈ ਪਹਿਲਾਂ ਇੰਟਰਨੈਟ ਜੇ ਅਸੀਂ ਮੋਬਾਈਲ ਦੇ ਬਾਰੇ ਗੱਲ ਕਰਦੇ ਹਾਂ ਤਾਂ ਪਹਿਲਾਂ ਸਾਨੂੰ ਇੱਕ ਮਹੀਨੇ ਦੇ ਲਈ ਸਿਰਫ ਇੱਕ ਜੀ ਵੀ ਮੈੱਟ ਹੀ ਮਿਲਦਾ ਹੁੰਦਾ ਸੀ ਅਤੇ ਹੁਣ ਦੇ ਟਾਈਮ ਦੇ ਵਿੱਚ ਸਾਨੂੰ ਇੰਟਰਨੈਟ ਅਨਲਿਮਟਿਡ ਪ੍ਰਤੀ ਦਿਨ ਦੇ ਅਕੋਰਡਿੰਗ ਮਿਲਦਾ ਹੈ ਮਿਲਦਾ ਹੈ ਅਤੇ ਪਹਿਲਾਂ ਦੇ ਇੰਟਰਨੈਟ ਬਹੁਤ ਹੀ ਘੱਟ ਸਪੀਡ ਦੇ ਚਲਦੇ ਸਨ ਅਤੇ ਹੁਣ ਦੇ ਇੰਟਰਨੈਟ ਬਹੁਤ ਹੀ ਤੇਜ਼ ਸਪੀਡ ਨਾਲ ਚੱਲਦੇ ਹਨ ਅਸੀਂ ਬਹੁਤ ਪਹਿਲਾਂ ਦੇ ਇੰਟਰਨੈਟ ਦੇ ਵਿੱਚ ਅਸੀਂ ਕਿਸੇ ਨਾਲ ਗੱਲਬਾਤ ਕਰਨ ਲਈ ਸਾਨੂੰ ਕਾਫੀ ਦੇਰ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਹੁਣ ਅਸੀਂ ਬਹੁਤ ਹੀ ਜਲਦੀ ਇੱਕ ਦੂਜੇ ਨਾਲ ਕਨੈਕਟ ਕਰ ਸਕਦੇ ਹਾਂ ਅਤੇ ਬਹੁਤ ਹੀ ਜਲਦੀ ਅਸੀਂ ਇੱਕ ਦੂਜੇ ਨੂੰ ਜੋ ਕੁਛ ਵੀ ਭੇਜਣਾ ਹੈ ਉਹ ਭੇਜ ਸਕਦੇ ਹਾਂ